ਮੈਂ ਰਾਮਾਇਣ ਰਾਮਚਰਿਤ ਮਾਨਸ ਤੁਲਸੀਦਾਸ ਜੀ ਵੱਲੋਂ ਲਿਖੀ ਹੋਈ ਰਾਮਚਰਿਤ ਮਾਨਸ ਪੜ੍ਹੀ ਸੀ ਉਹ ਮੈਨੂੰ ਕਿਤਾਬ ਇਹ ਇਹ ਧਾਰਮਿਕ ਕਿਤਾਬ ਬਹੁਤ ਹੀ ਅੱਛੀ ਲੱਗੀ ਹੈ ਇਹਦੇ ਵਿੱਚ ਚੁਣੌਤੀ ਇਹੋ ਹੀ ਹੈ ਚੁਣੌਤੀ ਇਹ ਕਿ ਇਹਦੇ ਵਿੱਚ ਬੜਾ ਕੁਝ ਦੱਸਿਆ ਵਾ ਕਿ ਇੱਕ ਪਤਨੀ ਨੂੰ ਆਪਣੇ ਪਤੀ ਨਾਲ ਕਿਸ ਤਰ੍ਹਾਂ ਪ੍ਰੇਮ ਕਰਨਾ ਚਾਹੀਦਾ ਪਤਨੀ ਨੂੰ ਬੱਚਿਆਂ ਨੂੰ ਕਿਸ ਤਰ੍ਹਾਂ ਪੜ੍ਹਾਈ ਲਿਖਾਈ ਜਾਂ ਉਹਨਾਂ ਦੀ ਸ਼ਿਕਸ਼ਾ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਇਹਦੇ ਵਿੱਚ ਭਰਾਵਾਂ ਦਾ ਕਿੰਨਾ ਆਪਸ ਵਿੱਚ ਪਿਆਰ ਹੋਣਾ ਚਾਹੀਦਾ ਹੈ ਪਿਤਾ ਦਾ ਪੁੱਤਰ ਦੇ ਪ੍ਰਤੀ ਪੁੱਤਰ ਦਾ ਪਿਤਾ ਦੇ ਪ੍ਰਤੀ ਕੀ ਫਰਜ਼ ਹੋਣਾ ਚਾਹੀਦਾ ਹੈ ਸਾਡਾ ਆਪਣੇ ਗੁਰੂ ਦੇ ਪ੍ਰਤੀ ਕੀ ਫਰਜ਼ ਹੈ ਆਪਸ ਵਿੱਚ ਇਹ ਸਾਰੇ ਇੱਕ ਘਰੇਲੂ ਕਿਤਾਬ ਹੈ ਸਾਰੇ ਰਿਸ਼ੀ ਰਿਸ਼ਤੇ ਦਾ ਆਪਣੇ ਰਿਸ਼ਤੇ ਸਾਡੇ ਸਾਨੂੰ ਕਿਸ ਤਰ੍ਹਾਂ ਆਪਣੇ ਰਿਸ਼ਤੇ ਨਿਭਾਉਣੇ ਚਾਹੀਦੇ ਹਨ ਇਹ ਆਮ ਅੱਜ ਕੱਲ੍ਹ ਦੇ ਯੁੱਗ ਵਿੱਚੋਂ ਹੁਣ ਅੱਜ ਕਲ੍ਹ ਸੰਸਾਰ ਦੇ ਵਿੱਚ ਇਹ ਚੀਜ਼ਾਂ ਘਟਦੀਆਂ ਜਾਂਦੀਆਂ ਹਨ ਭਰਾਵਾਂ ਭਰਾਵਾਂ 'ਚ ਪਿਆਰ ਨਹੀਂ ਰਿਹਾ ਇੱਕ ਭਰਾ ਦੂਜੇ ਭਰਾ ਦੇ ਖੂਨ ਦਾ ਪਿਆਸਾ ਹੋਇਆ ਹੈ ਜ਼ਮੀਨ ਦੇ ਇੰਨੇ ਜਿਹੇ ਟੁਕੜੇ ਛੋਟੇ ਜਿਹੇ ਦੋ ਦੋ ਗਜ਼ ਦੇ ਟੁਕੜੇ ਵਾਸਤੇ ਵੀ ਮਾਰਕਾਟ ਹੋ ਜਾਂਦੀ ਹੈ ਲੜਾਈ ਝਗੜੇ ਹੋਜੇ ਹਨ ਖੂਨ ਹੋਜੇ ਹਨ ਇੱਕ ਰਾਮਚਰਿਤ ਮਾਨਸ 'ਚ ਦੇਖੋ ਕਿ ਭਰਤ ਨੂੰ ਸਾਰਾ ਸਾਰਾ ਜਿਹੜਾ ਉਹਨੂੰ ਸਿੰ ਸਿੰਘਾਸਨ ਮਿਲ ਰਿਹਾ ਸੀ ਲੇਕਿਨ ਉਹਨੇ ਉਹ ਸਿੰਘਾਸਨ 'ਤੇ ਨਹੀਂ ਬੈਠੇ ਕਿਉਂਕਿ ਉਹਨਾਂ ਨੂੰ ਕਿਹਾ ਨਹੀਂ ਇਹ ਸਿੰਘਾਸਨ ਮੇਰੇ ਵੱਡੇ ਭਰਾ ਦਾ ਹੈ ਉਹਨਾਂ ਦੀ ਅਮਾਨਤ ਹੈ ਉਹਨਾਂ ਨੇ ਰਾਜ ਨਹੀਂ ਕੀਤਾ ਉਹਨਾਂ ਨੇ ਦੇਖੋ ਐਡਾ ਵੱਡਾ ਰਾਜਯ ਛੱਡ ਦਿੱਤਾ ਅਤੇ ਲੇਕਿਨ ਅੱਜ ਕੱਲ੍ਹ ਅੱਜ ਕੱਲ੍ਹ ਦੇ ਵਿੱਚ ਤਾਂ ਅਸੀਂ ਆਪਣੀ ਇੱਕ ਪੰਜ ਰੁਪਈਏ ਨਹੀਂ ਛੱਡਣ ਨੂੰ ਤਿਆਰ ਹੈਗੇ ਇਹ ਬੜੀ ਚੁਣੌਤੀਪੂਰਨ ਇਸ ਪਿੱਛੇ ਇਹ ਇਹ ਚੀਜ਼ਾਂ ਨੂੰ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਨਾਲ ਵੀ ਡਿਸਕਸ ਕੀਤਾ ਅਤੇ ਹਰ ਇੱਕ ਨੂੰ ਇਹ ਗੱਲਾਂ ਅੱਛੀਆਂ ਲੱਗੀਆਂ ਇਸ ਵਿੱਚ ਇਹ ਹਰ ਕਿਸੇ ਆਦਮੀ ਨੂੰ ਆਪਣੇ ਜੀਵਨ ਵਿੱਚ ਰਾਮਾਇਣ ਦਾ ਪਾਠ ਰਾਮਾਇਣ ਜ਼ਰੂਰ ਪੜ੍ਹਨੀ ਚਾਹੀਦੀ ਹੈ ਇਹਦੇ ਵਿੱਚ ਬੜੀਆਂ ਸ਼ਿਕਸ਼ਾ ਹਨ ਏ ਤੋਂ ਲੈ ਕੇ ਜੈੱਡ ਤੱਕ ਸ਼ਿਕਸ਼ਾ ਨਾਲ ਹੀ ਭਰਿਆ ਹੈ ਸਾਰਾ ਇਹਦੇ ਵਿੱਚ ਇਹ ਇੱਕ ਸੰਪੂਰਨ ਸੰਪੂਰਨ ਗ੍ਰੰਥ ਹੈ ਸ਼ੁਕਰੀਆ